ਹੈਲੋ ਹਾਂਜੀ ਮੈਂ ਅਮਨ ਗੱਲ ਕਰ ਰਿਹਾ ਸੀ ਤੁਹਾਡੇ ਫਲੋਰ ਤੋਂ ਮੈਂ ਹੁਣੇ ਹੋਟਲ ਜਦੋਂ ਮਿਲਿਆ ਇਕ ਹਾਂਜੀ ਮੈਂ ਬਸ ਇਹ ਪੁੱਛਣਾ ਸੀ ਵੀ ਹੋਟਲ ਦੇ ਰੂਮ ਦੇ ਵਿੱਚ ਪੱਖਾ ਚਲਾਈਏ ਮੈਡਮ ਪੱਖਾ ਚਲਾਉਦੇ ਆ ਤੇ ਕਦੇ ਪੱਖਾ ਬੰਦ ਹੋ ਜਾਂਦਾ ਚਲਦਾ ਕਦੇ ਜੇ ਟੀਵੀ ਚੱਲ ਜਾਂਦਾ ਪੱਖੇ ਦੇ ਵਿੱਚ ਥੋੜੀ ਜੀ ਦਿੱਕਤ ਆ ਜਾਂਦੀ ਹੈ ਇਹਦਾ ਦੱਸੋ ਕੀ ਕਰੀਏ ਮੈਡਮ ਹਾਂਜੀ ਹਾਂਜੀ ਹਾਂਜੀ ਠੀਕ ਐ ਜੀ ਅੱਛਾ ਜੀ ਹਾਂਜੀ ਹਾਂਜੀ ਬੇਟੇ ਟੀਵੀ ਪੱਖਾ ਦੋਵੇਂ ਹੀ ਚਲਾਣੇ ਸੀ ਪੱਖਾ ਨਾ ਪੱਖਾ ਹਾਂਜੀ ਹਾਂਜੀ ਡਰੋਰ ਦੇ ਕੋਲ ਡਰੋਰ ਦੇ ਬਿਲਕੁਲ ਨਾਲ ਇੱਕ ਤਾਂ ਇੱਕ ਬਟਨ ਐ ਸ਼ੋ ਵਾਲਾ ਤੋ ਹਾਂ ਸੂ ਦੇ ਨਾਲ ਹਾਂਜੀ ਉਹ ਸ਼ੂ ਟੀਵੀ ਦਾ ਐ

ਠੀਕ ਕਰੋ ਤਾਂ ਹੀ ਤੁਹਾਨੂੰ ਕਾਲ ਕਰਕੇ ਪੁੱਛਿਆ ਇੱਕ ਪੱਖੇ ਦੀ ਟੀਵੀ ਦੀ ਇਹਦੀ ਬਸ ਦਿੱਕਤ ਆ ਰਹੀ ਸੀ ਮਿੰਟ ਬਾਅਦ ਥੋੜੀ ਦੇਰ ਚੱਲਦੀ ਫਿਰ ਬੰਦ ਹੋ ਜਾਂਦੀ ਏ ਫਿਰ ਚੱਲਦੀ ਫਿਰ ਬੰਦ ਹੋ ਜਾਂਦੀ ਏ ਇਹਦਾ ਕੀ ਕਰਾਂ ਜੀ ਤਾਂ ਤੁਸੀਂ ਕੋਈ

ਠੀਕ ਐ ਹੋਰ ਹਾਂਜੀ ਕੋਈ ਫਿਲਹਾਲ ਇਸ ਤੋਂ ਇਲਾਵਾ ਕੋਈ ਹੋਰ ਦਿੱਕਤ ਨਹੀਂ ਬਸ ਇਹੀ ਦਿੱਕਤ ਸੀਗੀ ਜਿਹੜੀ ਵਾਰ ਵਾਰ ਤੰਗ ਕਰ ਰਹੀ ਸੀ ਮੈਨੂੰ ਨਹੀਂ ਬਸ ਹੋਰ ਤਾਂ ਅਸੀਂ ਬਿਲਕੁਲ ਓਕੇ ਚੱਲ ਰਿਹਾ ਜਗਰ ਵਗੈਰਾ ਗੀਜਰ ਵਗੈਰਾ ਜਦੋਂ ਤੱਕ ਅਗਰ ਯੂਜ ਕੀਤਾ ਯੂਜ ਕਰੂਗਾ ਮੈਂ ਤਾਂ ਮੈਂ ਤੁਹਾਨੂੰ ਦੱਸ ਦੂ ਅਗਰ ਕੋਈ ਦਿੱਕਤ ਹੋਈ ਤਾਂ ਮੈਂ ਤੁਹਾਨੂੰ ਜਰੂਰ ਦੱਸੂਗਾ ਮੈਂ ਕਰਕੇ ਹਾਂਜੀ ਮੈਂ ਤੁਹਾਨੂੰ ਬਟਨ ਕਰਕੇ ਮੈਂ ਤੁਹਾਨੂੰ ਦੱਸਦਾ ਠੀਕ ਐ ਮੈਂ ਹੁਣ ਦੱਸਦਾ ਇੱਕ ਮਿੰਟ ਵੇਟ ਕਰੋ ਹਾਂਜੀ ਹਾਂਜੀ ਗੀਜ਼ਰ ਬਿਲਕੁਲ ਤੁਸੀਂ ਚੱਲ ਰਹੇ ਬਾਕੀ ਓਕੇ ਬਾਕੀ ਹੋਰ ਠੀਕ ਏ ਸਾਰਾ ਥੈਂਕ ਯੂ ਜੀ ਠੀਕ ਏ